ਮੇਰਾ ਮਨਪਸੰਦ ਫੋਟੋਗ੍ਰਾਫਰ ਵਿੱਚੋਂ ਇੱਕ ਫੋਟੋਗ੍ਰਾਫਰ ਹੈ ਮੈਂ ਆਪਣੇ ਘਰ ਵਿੱਚ ਕਈ ਫੰਕਸ਼ਨ ਕਰਵਾਏ ਦੋ ਤਿੰਨ ਫੰਕਸ਼ਨ ਕਰਵਾਏ ਮੈਨੂੰ ਉਹਨਾਂ ਵਿੱਚੋਂ ਇੱਕ ਫੋਟੋਗ੍ਰਾਫਰ ਰਾਹੁਲ ਹੈਗਾ ਜੋ ਉਹ ਬਹੁਤ ਵਧੀਆ ਲੱਗਾ ਉਹਦਾ ਫੋਟੋ ਖਿੱਚਣ ਦਾ ਵੀ ਤਰੀਕਾ ਬਹੁਤ ਵਧੀਆ ਲੱਗਾ ਫੋਟੋ ਦੀ ਕਲੈਰਟੀ ਵੀ ਬਹੁਤ ਵਧੀਆ ਸੀ ਇਸ ਲਈ ਮੈਂ ਉਹਨੂੰ ਹੀ ਹੁਣ ਜੋ ਵੀ ਕੋਈ ਫੰਕਸ਼ਨ ਹੋਵੇ ਰਾਹੁਲ ਨੂੰ ਹੀ ਫੋਟੋਗ੍ਰਾਫਰ ਲਈ ਸੱਦਦਾ ਹਾਂ ਕਿਉਂਕਿ ਉਹ ਕੋਈ ਵੀ ਫੰ ਫੰਕਸ਼ਨ ਵਿੱਚ ਟਾਈਮ ਵੱਧ ਵੀ ਲੱਗ ਜਾਵੇ ਦੋ ਘੰਟੇ ਦੀ ਬਜਾਇ ਤਿੰਨ ਘੰਟੇ ਵੀ ਲੱਗ ਜਾਵੇ ਤਾਂ ਉਹ ਕੋਈ ਚੈਂ ਚੈਂ ਨਹੀਂ ਕਰਦਾ ਪੈਸੇ ਵੀ ਬਿਲਕੁਲ ਬਿਲਕੁਲ ਜਾਇਜ਼ ਜਿਹੇ ਜਾਇਜ਼ ਲੈਂਦਾ ਹੈ ਅਤੇ ਫੋਟੋ ਦੀ ਕੁਆਲਿਟੀ ਹੀ ਵੀ ਵਧੀਆ ਦਿੰਦਾ ਹੈ ਇਸ ਲਈ ਮੇਰਾ ਮਨਪਸੰਦ ਫੋਟੋਗ੍ਰਾਫਰ ਰਾਹੁਲ ਹੀ ਹੈ ਤਾਂ ਕਿ ਜਦੋਂ ਵੀ ਉਹਨੂੰ ਫੋਨ ਕਰੀਏ ਘਰ ਵਿੱਚ ਫੰਕਸ਼ਨ ਹੋਵੇ ਉਹ ਆਰਾਮ ਨਾਲ ਆ ਕੇ ਫੋ ਫੋਟੋਆਂ ਵਧੀਆ ਖਿੱਚਦਾ ਹੈ ਅਤੇ ਯਾਦਗਾਰੀ ਉਹ ਫੋਟੋਆਂ ਰਹਿ ਜਾਂਦੀਆਂ ਹਨ ਇਸ ਲਈ ਮੈਂ ਹੁਣ ਕਦੋਂ ਜਦੋਂ ਵੀ ਪ੍ਰੋਗਰਾਮ ਕਰਾਵਾਂ ਤਾਂ ਇਹਨੂੰ ਹੀ ਸੱਦਦਾ ਹਾਂ